ਅਸੀਂ ਦੱਸ ਸਕਦੇ ਹਾਂ ਕਿ ਭੰਗੜੇ ਦੀ ਸਾਡੇ ਦੇਸ਼ ਅਤੇ ਪੰਜਾਬ ਵਿੱਚ ਬਹੁਤ ਮਹੱਤਤਾ ਹੈ ਭੰਗੜਾ ਸਿਰਫ ਪੰਜਾਬ ਵਿੱਚ ਹੀ ਨਹੀਂ ਦੇਸ਼ ਦੇ ਹਰ ਇੱਕ ਕੋਨੇ ਵਿੱਚ ਪਾਇਆ ਜਾਂਦਾ ਹੈ ਪਰ ਉਸ ਨੂੰ ਅਲੱਗ ਅਲੱਗ ਨਾਮਾਂ ਨਾਲ ਜਾਣਿਆ ਜਾਂਦਾ ਹੈ ਭੰਗੜਾ ਆਮ ਤੌਰ 'ਤੇ ਕਾਲਜਾਂ ਸਕੂਲਾਂ ਅਤੇ ਕਿਸੇ ਵਿਸ਼ੇਸ਼ ਪ੍ਰੋਗਰਾਮ 'ਤੇ ਹੀ ਪਾਇਆ ਜਾਂਦਾ ਹੈ ਵਿਆਹਾਂ ਦੇ ਵਿੱਚ ਭੰਗੜਾ ਆਮ ਤੌਰ 'ਤੇ ਮੁੰਡੇ ਅਤੇ ਕੁੜੀਆਂ ਦੋਨਾਂ ਵੱਲੋਂ ਪਾਇਆ ਜਾਂਦਾ ਹੈ ਭੰਗੜਾ ਸਿਰਫ ਪੰਜਾਬ ਵਿੱਚ ਹੀ ਨਹੀਂ ਦੁਨੀਆਂ ਦੇ ਹਰ ਇੱਕ ਕੋਨੇ ਵਿੱਚ ਵੀ ਪ੍ਰਚਲਿਤ ਹੁੰਦਾ ਹੈ ਭੰਗੜਾ ਕਹਿ ਸਕਦੇ ਹਾਂ ਕਿ ਕਾਲਜਾਂ ਦੇ ਵਿੱਚ ਜਦੋਂ ਅਸੀਂ ਭੰਗੜਾ ਪਾਉਂਦੇ ਹਾਂ ਤਾਂ ਸਾਡੇ ਵਿੱਚ ਜੋਸ਼ ਸ਼ਕਤੀ ਪੈਦਾ ਹੁੰਦੀ ਹੈ ਭੰਗੜੇ ਦੇ ਨਾਲ ਹੀ ਅਸੀਂ ਵੱਖ ਵੱਖ ਚੀਜ਼ਾਂ ਦੇਖ ਸਕਦੇ ਹਾਂ ਭੰਗੜਾ ਸਾਨੂੰ ਮਾਨਸਿਕ ਅਤੇ ਸਰੀਰਿਕ ਰੂਪ ਤੋਂ ਵਧੀਆ ਬਣਾਉਂਦਾ ਹੈ ਭੰਗੜੇ ਦੇ ਨਾਲ ਸਾਨੂੰ ਕੰਮ ਕਰਨ ਦੀ ਸ਼ਕਤੀ ਅਤੇ ਕੰਮ ਕਰਨ ਦਾ ਤਰੀਕਾ ਪਤਾ ਲੱਗਦਾ ਹੈ ਸਾਨੂੰ ਪਤਾ ਹੁੰਦਾ ਹੈ ਕਿ ਭੰਗੜੇ ਨੂੰ ਕਿਸ ਤਰ੍ਹਾਂ ਆਪਾਂ ਵਰਤ ਸਕਦੇ ਹਾਂ ਭੰਗੜਾ ਸਾਡੇ ਸਰੀਰ ਅਤੇ ਮਾਨਸਿਕਤਾ ਨੂੰ ਸਕਾਰਾਤਮਕ ਪੈਦਾ ਕਰਦਾ ਹੈ ਭੰਗੜਾ ਬਹੁਤ ਹੀ ਵਧੀਆ ਅਤੇ ਬਹੁਤ ਹੀ ਵਧੀਆ ਚੀਜ਼ ਹੈ ਭੰਗੜੇ ਦੇ ਨਾਲ ਪੰਜਾਬੀਆਂ ਦਾ ਗੂੜਾ ਸੰਬੰਧ ਹੈ ਖੁਸ਼ੀ ਦੇ ਵਿੱਚ ਭੰਗੜੇ ਨੂੰ ਪੂਰੀ ਲੋਰ ਦੇ ਨਾਲ ਪਾਇਆ ਜਾਂਦਾ ਹੈ ਕਾਲਜਾਂ ਦੇ ਵਿੱਚ ਇਹਨਾਂ ਦੇ ਕੰਮ ਕਰਵਾਏ ਜਾਂਦੇ ਹਨ ਭੰਗੜਾ ਮੁੰਡਿਆਂ ਦੁਆਰਾ ਬਹੁਤ ਹੀ ਸੋਹਣੇ ਅਤੇ ਸੁਚੱਜੇ ਰੂਪ ਨਾਲ ਪਾਇਆ ਜਾਂਦਾ ਹੈ ਅਤੇ ਭੰਗੜਾ ਕੁੜੀਆਂ ਦੁਆਰਾ ਵੀ ਬੜੇ ਸੁਚੱਜੇ ਰੂਪ ਨਾਲ ਪਾਇਆ ਜਾਂਦਾ ਹੈ ਇਸੇ ਤਰ੍ਹਾਂ ਅਸੀਂ ਦੱਸ ਸਕਦੇ ਹਾਂ ਕਿ ਭੰਗੜਾ ਸਾਡੇ ਸਮਾਜ ਅਤੇ ਸਾਡੇ ਬਹੁ ਰੂਪੀ ਹਿੱਸਿਆਂ ਵਿੱਚ ਕੰਮ ਕਰਦਾ ਹੈ ਧੰਨਵਾਦ